ਮੇਰੀ ਮਨਪਸੰਦ ਕਿਤਾਬ ਮੜੀ ਦਾ ਦੀਵਾ ਹੈ ਇਹ ਪੇਂਡੂ ਖੇਤਰ ਦੇ ਮਜ਼ਦੂਰ ਜਮਾਤ ਦੇ ਨਾਲ ਸੰਬੰਧਿਤ ਹੈ ਇਹ ਕਿਤਾਬ ਮੈਂ ਕਈ ਵਾਰ ਪੜ੍ਹੀ ਹੈ ਅਤੇ ਮੈਂ ਇਸ 'ਤੇ ਇੱਕ ਫਿਲਮ ਵੀ ਵੇਖੀ ਹੈ ਮੈਂ ਇਹ ਚਾਹੁੰਦਾ ਹਾਂ ਕਿ ਇਸ 'ਤੇ ਹੋਰ ਪੰਜਾਬੀ ਫਿਲਮਾਂ ਬਣਨੀਆਂ ਚਾਹੀਦੀਆਂ ਹਨ